ਹੈਲੋ ਹਾਂਜੀ ਤੁਸੀਂ ਐਚ ਪੀ ਏਜੰਸੀ ਤੋਂ ਬੋਲ ਰਹੇ ਹੋ ਜੀ ਹਾਂਜੀ ਮੇਰੇ ਘਰ ਫੰਕਸ਼ਨ ਰੱਖਿਆ ਹੋਇਆ ਜੀ ਸੋ ਮੈਂ ਸਿਰੰਡਰ ਬੁੱਕ ਕਰਵਾਇਆ ਸੀ ਜੀ ਮੇਰਾ ਰੈਫਰੈਂਸ ਨੰਬਰ ਇੱਕ ਦੋ ਤਿੰਨ ਚਾਰ ਅਤੇ ਮੇਰਾ ਆਧਾਰ ਨੰਬਰ ਛੇ ਸੱਤ ਅੱਠ ਹੈ ਜੀ ਅਤੇ ਮੈਨੂੰ ਸਿਲੰਡਰ ਦੀ ਬਹੁਤ ਲੋੜ ਪੈ ਰਹੀ ਹੈ ਜੀ ਸੋ ਤੁਸੀਂ ਐਚ ਪੀ ਏਜੰਸੀ ਨੂੰ ਕਾਲ ਕਰਕੇ ਉਹਨਾਂ ਨੂੰ ਉਸ ਆਪਣੇ ਪਤਾ ਕਰ ਸਕਦੇ ਹੋ ਸਰ ਜੀ ਅਤੇ ਮੈਨੂੰ ਤੁਹਾਡੀ ਸਹਾਇਤਾ ਦੀ ਬਹੁਤ ਲੋੜ ਹੈ ਉਹਨਾਂ ਨੂੰ ਤੁਸੀਂ ਕਹਿ ਕੇ ਥੋੜ੍ਹਾ ਜਿਹਾ ਮੇਰੀ ਹੈਲਪ ਕਰੋ ਜੀ